ਵੈਸੇ ਤਾਂ ਸਾਡੇ ਬਹੁਤ ਸਾਰੇ ਧਾਰਮਿਕ ਤਿਉਹਾਰ ਨੇ ਲੇਕਿਨ ਆਪਾਂ ਲੋਹੜੀ ਦੇ ਤਿਉਹਾਰ ਤੋਂ ਆਪਣੇ ਸਾਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਇਸ ਤਿਉਹਾਰ ਵਿੱਚ ਆਪਾਂ ਮੂੰਗਫਲੀਆਂ ਰਿਉੜੀਆਂ ਭੁੱਗਾ ਅਤੇ ਗੰਨੇ ਦੇ ਰੋਹ ਦੀ ਖੀਰ ਬਣਾ ਕੇ ਖਾਂਦੇ ਹਾਂ ਅਤੇ ਇੱਕ ਦੂਸਰੇ ਨੂੰ ਵੀ ਖਵਾਉਂਦੇ ਹਾਂ ਇਸ ਤੋਂ ਬਾਅਦ ਵਿਸਾਖੀ ਦਾ ਤਿਉਹਾਰ ਆਉਂਦਾ ਹੈ ਜਿਸ ਵਿੱਚ ਆਪਾਂ ਇਮਰਤੀਆਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਦਿ ਵਗੈਰਾ ਖਾਂਦੇ ਹਾਂ ਅਤੇ ਇਸ ਤੋਂ ਇਲਾਵਾ ਉਸ ਤੋਂ ਬਾ ਆਪਾਂ ਹਰ ਮਹੀਨੇ ਸਾਡੇ ਸੰਗਰਾਂਦ ਦਾ ਤਿਉ ਤਿਉਹਾਰ ਆਉਂਦਾ ਹੈ ਜਿਸ ਵਿੱਚ ਆਪਾਂ ਗੁਰੂ ਦਾ ਲੰਗਰ ਬਣਾ ਕੇ ਇੱਕ ਦੂਸ ਗੁਰੂ ਦੇ ਲੰਗਰ ਨੂੰ ਵੰਡਦੇ ਹਾਂ ਅਤੇ ਗੁਰੂ ਨੂੰ ਵੀ ਭੋਗ ਲਵਾਉਦੇ ਹਾਂ ਉਸ ਤੋਂ ਬਾਅਦ ਆਪਾਂ ਸਾਡਾ ਤਿਉਹਾਰ ਆਉਂਦਾ ਹੈ ਦਿਵਾਲੀ ਦਾ ਤਿਉਹਾਰ ਦਿਵਾਲੀ ਦੇ ਤਿਉਹਾਰ ਵਿੱਚ ਆਪਾਂ ਮਿਠਾਈਆਂ ਖਾਂਦੇ ਹਾਂ ਅਤੇ ਵੰਡਦੇ ਹਾਂ ਇਹਨਾਂ ਮਿਠਾਈਆਂ ਵਿੱਚ ਕ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਜਿਵੇਂ ਜਲੇਬੀਆਂ ਇਮਰਤੀਆਂ ਲੱਡੂ ਬਰਫੀਆਂ ਆਦਿ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਹਨ ਜੋ ਆਪਾਂ ਖਾਂਦੇ ਵੀ ਹਾਂ ਅਤੇ ਵੰਡਦੇ ਵੀ ਹਾਂ ਸੋਨ ਪਾਪੜੀ ਆਦਿ ਇਸ ਤੋਂ ਬਾਅਦ ਸਾਡਾ ਤਿਉਹਾਰ ਦੁਸਹਿਰੇ ਦੁਸਹਿਰੇ ਦੇ ਤਿਉਹਾਰ 'ਤੇ ਆਪਾਂ ਜਲੇਬੀਆਂ ਜਲੇਬੀਆਂ ਵਗੈਰਾ ਖਾਂਦੇ ਹਾਂ ਅਤੇ ਉਸ ਤੋਂ ਇਲਾਵਾ ਸਾਡੇ ਕਾਫੀ ਤਿਉਹਾਰ ਆਉਂਦੇ ਹਨ ਜਿਸ ਵਿੱਚ ਖਾਣ ਪੀਣ ਦੀ ਚੀਜ਼ਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਹਨ ਲੇਕਿਨ ਆਪਾਂ ਹਰ ਤਿਉਹਾਰ ਵਿੱਚ ਮਿੱਠ ਮਿੱਠੇ ਨਾਲ ਸ਼ੁਰੂਆਤ ਕਰਦੇ ਹਾਂ ਅਤੇ ਮਿੱਠੇ ਨਾਲ ਹੀ ਆਪਾਂ ਅੰਤ ਕਰਦੇ ਹਾਂ ਧੰਨਵਾਦ